ਹੈਲੋ ਅੱਜ ਤੁਸੀਂ ਅੱਛਾ ਅੱਜ ਨਾ ਮੇਰੀ ਤਬੀਅਤ ਨਹੀਂ ਠੀਕ ਸੀ ਥੋੜ੍ਹਾ ਜਿਹਾ ਕੰਮ ਵੀ ਹੈਗਾ ਸੀ ਘਰੇ ਤਾਂ ਨਹੀਂ ਮੈਂ ਆਈ ਸੀ ਅੱਜ ਅੱਛਾ ਅਤੇ ਕੀ ਕਹਿ ਕੇ ਗਏ ਨੇ ਅੱਛਾ ਫਿਰ ਅੱਛਾ ਫਿਰ ਮੈਨੂੰ ਪਤਾ ਨਹੀਂ ਸੀ ਨਾ ਬਾਹਰੋਂ ਆਉਂਦੇ ਪਏ ਨੇ ਹਾਂਜੀ ਛੁੱਟੀ ਸੀ ਅੱਜ ਹਾਂ ਦਿੱਤੀ ਸੀ ਅੱਛਾ ਫਿਰ ਮੈਨੂੰ ਪਤਾ ਨਹੀਂ ਸੀ ਨਾ ਮੈਨੂੰ ਵੀ ਜ਼ਰੂਰੀ ਕੰਮ ਹੈਗਾ ਸੀ ਅੱਜ

ਅੱਛਾ ਅੱਛਾ ਠੀਕ ਏ ਲਗਾਤੀ ਮੈਂ ਕੋਸ਼ਿਸ਼ ਪੂਰੀ ਕਰਾਂਗੀ ਆਵਾਂਗੀ ਅੱਛਾ ਜੀ ਠੀਕ ਏ ਅੱਛਾ ਜੀ ਅੱਛਾ ਅੱਛਾ ਜੀ ਨਹੀਂ ਮਾਰਦੇ ਦੱਸੋ ਕਰਨਾ ਕੀ ਹੈ ਅੱਗੋਂ ਠੀਕ ਠੀਕ ਏ ਸਕੂਲ ਵਿੱਚ ਫੰਕਸ਼ਨ ਕਾਹਦਾ ਕਰਦੇ ਪਏ ਜੇ ਅੱਛਾ ਠੀਕ ਏ ਆ ਜਾਂਗੇ ਜੀ ਠੀਕ